ਹੈਲੋ ਹਾਂਜੀ ਸਟੀਚਿੰਗ ਸ਼ੋਪ ਤੋਂ ਬੋਲ ਰਹੇ ਟੇਲਰ ਜੀ ਨਾਲ ਗੱਲ ਕਰਨੀ ਸੀਗੀ ਇਹ ਅਸੀ ਨਾ ਬਰਾਈਡਲ ਸੂਟ ਤਿਆਰ ਕਰਵਾਉਣਾ ਸੀਗਾ ਬਰਾਈਡਲ ਸੂਟ ਤਿਆਰ ਕਰਵਾਉਣਾ ਸੀ ਬਰਾਈਡਲ ਸੂਟ ਹਾਂਜੀ ਕੀ ਚਾਰਜਸ ਵਗੈਰਾ ਜੀ ਉਹਦੇ ਹਾਂਜੀ ਵਧੀਆ ਪਿਓਰ ਪੰਜਾਬੀ ਬਰਾਈਡਲ ਸੂਟ ਤਿਆਰ ਕਰਾਉਣਾ ਜੀ ਮਹਿਰੂਨ ਕਲਰ ਦਾ ਅਤੇ ਪਾਕਿਸਤਾਨੀ ਸੂਟ ਤਿਆਰ ਕਰਾਉਣਾ ਜੀ ਕਰ ਦਿਓਗੇ ਹਾਂਜੀ ਮੈਂ ਸੂਟ ਦੀ ਡਿਜ਼ਾਇਨ ਵਧੀਆ ਹੋਵੇ ਤੁਹਾਨੂੰ ਸੂਟ ਗੋਟਾ ਲੋਨ ਵਗੈਰਾ ਸਾਰਾ ਅਸੀਂ ਤੁਹਾਨੂੰ ਦੇਵਾਂਗੇ ਬਸ ਤੁਸੀਂ ਡਿਜ਼ਾਇਨ ਹੀ ਵਧੀਆ ਤਿਆਰ ਕਰ ਦਿਓ ਸਾਨੂੰ ਹਾਂ ਨਹੀਂ ਨਹੀਂ ਉਹ ਅਸੀਂ ਆਪ ਦਾ ਹੀ ਲੈ ਕੇ ਆਵਾਂਗੇ ਹਾਂਜੀ ਬਰਾਈਡਲ ਸੂਟ ਆ ਨਾ ਫਿਰ ਉਹ ਬਰਾਈਡਲ ਨੂੰ ਆਪਣੀ ਚੋਇਸ ਦਾ ਹੀ ਦਵਾਵਾਂਗੇ ਆਪਣੀ ਚੋਇਸ ਦਾ ਲੈ ਕੇ ਆਵਾਂਗੇ ਬਸ ਤੁਹਾਡੇ ਕੋਲ ਸਟਿਚ ਕਰਵਾਉਣਾ ਜੀ ਸਟਿਚਿੰਗ 'ਚ ਨਹੀਂ ਕੋਈ ਉਹ ਨਹੀਂ ਚਾਹੀਦੀ ਦਿੱਕਤ ਹਾਂਜੀ ਹਾਂ ਨਹੀਂ ਨਹੀਂ ਕੋਈ ਗੱਲ ਨਹੀਂ ਹੈ ਤਾਂ ਅੱਗੇ ਪਹਿਲਾਂ ਵੀ ਅਸੀਂ ਕਾਫੀ ਸੂਟ ਤਿਆਰ ਕਰਵਾਏ ਤੁਹਾਡੇ ਤੋਂ ਐਂ ਤਾਂ ਸਾਨੂੰ ਪਤਾ ਤੁਹਾਡੇ ਕੰਮ ਦਾ ਪਰ ਹਾਂਜੀ ਹਾਂਜੀ ਹਾਂਜੀ ਪਰ ਥੋੜ੍ਹਾ ਬਰਾਈਡਲ ਸੂਟ ਦਾ ਹੋ ਜਾਂਦਾ ਨਾ ਜੀ ਬਈ ਵਿਆਹ ਵਾਲੀ ਕੁੜੀ ਨੂੰ ਸਾਰਿਆਂ ਨੇ ਦੇਖਣਾ ਹੁੰਦਾ ਫਿਰ ਵਿਆਹ ਵਾਲੀ ਕੁੜੀ ਦੇ ਸੂਟ 'ਚ ਨਹੀਂ ਕੋਈ ਕਮੀ ਆਉਣੀ ਚਾਹੀਦੀ ਨਹੀਂ ਨਹੀਂ ਹਾਂਜੀ ਹਾਂਜੀ ਅੱਜ ਕੱਲ੍ਹ ਹੁਣ ਲੇਟਿਸਟ ਡਿਜ਼ਾਇਨ ਪੰਜਾਬੀ ਸੂਟਾਂ 'ਚ ਬਹੁਤ ਚੱਲੇ ਪਏ ਆ ਜੀ ਹਾਂਜੀ ਉਹ ਅੱਜ ਕੱਲ੍ਹ ਉਹ ਖੁੱਲੀਆਂ ਅਮਰੇਲਾ ਕੱਟ ਬਾਹਵਾਂ ਚਲਦੀਆਂ ਨਾ ਉਦਾਂ ਅਤੇ ਬਸ ਬਈ ਲੋਂਗ ਲੋਂਗ ਜੈਪਰ ਨੈਰੋ ਸਲਵਾਰ ਸਟੇਟ ਸਟੇਟ ਨੈਰੋ ਪੋਂਚਿਆ ਵਾਲੀ ਅਤੇ ਹਾਂਜੀ ਹੈਵੀ ਗੋਟਾ ਦੁਪੱਟੇ 'ਤੇ ਕੰਟਰਾਸਟ ਬਣਾ ਕੇ ਹਾਂਜੀ ਇਸ ਤਰ੍ਹਾਂ ਤਿਆਰ ਕਰਾ

ਸੂਟ ਪਹਿਲਾਂ ਇੱਕ ਕਰਵਾਵਾਂਗੇ ਇਹ ਸੈਟ ਲੱਗਿਆ ਫਿਰ ਹੋਰ ਵੀ ਕਰਵਾ ਲਾਵਾਂਗੇ ਅਤੇ ਅਸੀਂ ਤੁਹਾਡੀ ਸ਼ੋਪ 'ਤੇ ਆ ਕੇ ਫਿਰ ਤੁਹਾਨੂੰ ਮਿਲਦੇ ਆ ਜੀ ਸਵੇਰੇ ਠੀਕ ਹੈ ਜੀ